ਵੈਸੇ ਤਾਂ ਮੈਨੂੰ ਬਹੁਤ ਸਾਰੇ ਫਿਲਮੀ ਸਿਤਾਰੇ ਪਸੰਦ ਹਨ ਜੇਕਰ ਮੈਂ ਜੋ ਜੋ ਫਿਲਮੀ ਸਿਤਾਰਾ ਮੈਨੂੰ ਸਭ ਤੋਂ ਜਿਆਦਾ ਪਸੰਦ ਹੈ ਉਹਨਾਂ ਦਾ ਨਾਮ ਹੈ ਗਿੱਪੀ ਗਰੇਵਾਲ ਇੱਕ ਵਾਰ ਮੈਂ ਸਾਡੇ ਪਟਿਆਲੇ ਦੇ ਫੂਲ ਸਿਨਮਾ ਵਿੱਚ ਫਿਲਮ ਦੇਖਣ ਗਈ ਸੀ ਕੈਰੀ ਓਨ ਜੱਟਾ ਅਤੇ ਜਦੋਂ ਓਹ ਫਿਲਮ ਖਤਮ ਹੋਈ ਤਾਂ ਗਿੱਪੀ ਗਰੇਵਾਲ ਨੇ ਉੱਥੇ ਆ ਕੇ ਖੁਦ ਆਪਣੀ ਓਡੀਐਂਸ ਨੂੰ ਸਰਪ੍ਰਾਈਜ਼ ਦਿੱਤਾ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਅਤੇ ਮੈਂ ਉਹਨਾਂ ਨੂੰ ਮਿਲੀ ਵੀ ਅਤੇ ਓਹਨਾਂ ਤੋਂ ਮੈਨੇ ਕਈ ਸਵਾਲ ਵੀ ਪੁੱਛੇ ਮੈਨੂੰ ਓਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਕਈ ਓਡੀਐਂਸ ਨੇ ਉਹਨਾਂ ਨਾਲ ਫੋਟੋ ਕਲਿੱਕ ਵੀ ਕਰਵਾਈ ਮੈਨੇ ਵੀ ਓਹਨਾਂ ਨਾਲ ਫੋਟੋ ਕਲਿੱਕ ਕਰਵਾਈ ਓਹਨਾਂ ਨਾਲ ਮੇਰਾ ਫਸ਼ਟ ਫਸ਼ਟ ਐਕਸਪੀਰੀਐਂਸ ਮਿਲਣ ਦਾ ਬਹੁਤ ਜ਼ਿਆਦਾ ਚੰਗਾ ਰਿਹਾ ਅਤੇ ਮੈਨੂੰ ਓਹਨਾਂ ਦਾ ਸੁਭਾਅ ਵੀ ਬਹੁਤ ਚੰਗਾ ਲੱਗਿਆ ਇਸ ਪਰ ਮੈਂ ਹੋਰ ਫਿਲਮੀ ਸਤਾਰੇ ਨੂੰ ਮੇਰੇ ਮੇਰੇ ਮਨ ਵਿੱਚ ਓਹਨਾਂ ਨੂੰ ਮਿਲਣ ਦੀ ਬਹੁਤ ਜ਼ਿਆਦਾ ਚਾਅ ਸੀ ਜਿਸ ਦਾ ਨਾਮ ਹੈ ਆਰ ਨੇਤ ਅਤੇ ਮੈਂ ਓਹਨਾਂ ਨੂੰ ਵੀ ਮਿਲਣਾ ਚਾਹਾਂਗੀ ਮੇਰੇ ਮਨ ਵਿੱਚ ਓਹਨਾਂ ਨੂੰ ਮਿਲਣ ਦੇ ਮੈਂ ਓਹਨਾਂ ਦੀ ਹਮੇਸ਼ਾਂ ਉਡੀਕ ਕਰਾਂਗੀ ਮੇਰੇ ਮਨ ਵਿੱਚ ਇਹੀ ਇੱਛਾ ਹੈ ਕਿ ਮੈਂ ਓਹਨਾਂ ਨੂੰ ਕਦੇ ਮਿਲਾਂ ਅਤੇ ਓਹਨਾਂ ਨੂੰ ਪੁੱਛਾਂ ਓਹਨਾਂ ਤੋਂ ਕਈ ਸਵਾਲ ਪੁੱਛਾਂ ਜਿਵੇਂ ਕਿ ਵੀ ਉਹ ਇੰਨੇ ਸਕਸੈੱਸਫੁੱਲ ਕਿਵੇਂ ਹੋਏ ਮੈਨੂੰ ਓਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗੇਗਾ ਮੇਰੇ ਮੈਨੂੰ ਓਹਨਾਂ ਨਾਲ ਮਿਲਣ ਦੀ ਉਡੀਕ ਹਮੇਸ਼ਾਂ ਰਹੇਗੀ